ਬੁਣਾਈ ਸਿਲਾਈ ਦਾ ਕੰਮ ਮੈਂ ਆਪਣੀ ਮੰਮੀ ਤੋਂ ਬਚਪਨ ਤੋਂ ਹੀ ਸਿੱਖਿਆ ਹੈ ਕਿਉਂਕੀ ਮੇਰੇ ਘਰ ਦਾ ਨਿੱਜੀ ਪ੍ਰੋਬਲਮ ਹੋਣ ਕਰਕੇ ਮੇਰੀ ਮੰਮੀ ਬੁਣਾਈ ਅਤੇ ਸਿਲਾਈ ਦਾ ਕੰਮ ਕਰਦੀ ਹੈ ਅਤੇ ਮੈਂ ਉਸਨੂੰ ਵੇਖ ਵੇਖ ਕੇ ਬਹੁਤ ਸਾਰੀਆਂ ਡਿਜ਼ਾਈਨਸ ਸਿੱਖ ਲਈਆਂ ਹਨ ਆਪਣੀ ਮੰਮੀ ਨੂੰ ਮੈਂ ਬਹੁਤ ਸਾਰੀ ਡਿਜ਼ਾਈਨਸ ਬਣਾ ਕੇ ਦਿੱਤਾ ਦਿੱਤਾ ਅਤੇ ਮੇਰੀ ਮੰਮੀ ਨੇ ਬਹੁਤ ਸ਼ਾਬਾਸ਼ੀ ਦਿੱਤਾ ਮੈਨੂੰ ਮੈਂ ਫਿਰ ਆਪਣੀ ਮੰਮੀ ਦੇ ਕੰਮ 'ਚ ਹੱਥ ਵਟਾਉਣ ਲੱਗੀ ਅਤੇ ਮੈਂ ਆਪਣੀ ਮੰਮੀ ਨੂੰ ਦੋ ਤਿੰਨ ਸੂਟ ਸਲਵਾਰ ਸਿ ਸਿਲ ਕੇ ਦੇ ਦਿੱਤਾ ਹੋਰ ਮੈਂ ਆਪਣੇ ਲਾਈਫ 'ਚ ਫੈਸ਼ਨ ਡਿਜ਼ਾਈਨਰ ਬਣ ਕੇ ਆਪਣੀ ਮੰਮੀ ਦਾ ਨਾਮ ਰੋਸ਼ਨ ਕਰਨਾ ਹੈ ਅਤੇ ਆਪਣੇ ਘ ਘਰ ਦਾ ਨਿੱਜੀ ਪ੍ਰੋਬਲਮ ਛੇਤੀ ਤੋਂ ਛੇਤੀ ਮੁਕਾ ਦੇਣਾ ਹੈ ਹੋਰ ਮੈਂ ਆਪਣੀ ਮੰਮੀ ਨੂੰ ਹੋਰ ਮੈਂ ਆਪਣੀ ਮੰਮੀ ਨੂੰ ਨੇ ਨਵੇਂ ਨਵੇਂ ਡਿਜ਼ਾਈਨਸ ਬਣਾ ਕੇ ਦਿਖਾਉਣਾ ਚਾਹੁੰਦੀ ਹਨ